ਸਾਡੇ ਪਿੰਡ ਦਾ ਡਰੇਨ ਸਿਸਟਮ ਬਹੁਤ ਹੀ ਵਧੀਆ ਹੈ ਪਰ ਇਸ ਨੂੰ ਸਹੀ ਚਲਾਉਣ ਲਈ ਸਿਰਫ਼ ਇੱਕ 'ਤੇ ਨਹੀਂ ਬਲਕਿ ਸਾਰੇ ਪਿੰਡ ਦੇ ਉੱਪਰ ਨਿਰਭਰ ਕਰਦਾ ਹੈ ਜੇਕਰ ਸਾਰਾ ਪਿੰਡ ਆਪਣੇ ਆਲੇ ਦੁਆਲੇ ਦੀ ਸਫਾਈ ਰੱਖਦਾ ਹੈ ਤਾਂ ਇਸ ਨੂੰ ਸੁਧਾਰਨ ਵਿੱਚ ਕਾਫ਼ੀ ਸਹਾਇਤਾ ਹੋ ਸਕਦੀ ਹੈ ਜ਼ਰੂਰੀ ਨਹੀਂ ਕਿ ਇੱਕ ਇਨਸਾਨ ਹੀ ਇਸ ਨੂੰ ਸਾਫ਼ ਕਰਨ ਦੀ ਜਿੰਮੇਵਾਰੀ ਲਏ ਬਲਕਿ ਸਾਨੂੰ ਸਾਰੇ ਪਿੰਡ ਨੂੰ ਰਲ ਕੇ ਇਸ ਨੂੰ ਸਾਫ਼ ਰੱਖਣ ਦੀ ਜਿੰਮੇਦਾਰੀ ਚੁੱਕਣੀ ਚਾਹੀਦੀ ਹੈ ਸਾਡੇ ਪਿੰਡ ਦਾ ਪਾਣੀ ਦਾ ਜੋ ਸਿਸਟਮ ਹੈ ਨਾਲੀਆਂ ਦਾ ਜੋ ਪਾਣੀ ਹੈ ਉਸ ਵਿੱਚ ਕਈ ਵਾਰ ਆਸੇ ਪਾਸੇ ਦੇ ਲੋਕ ਪੰਨੇ ਵਗੈਰਾ ਸਿੱਟ ਦਿੰਦੇ ਹਨ ਪਰ ਉਹਨਾਂ ਨੂੰ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਇਹ ਲਿਫਾਫੇ ਖਾਲੀਆਂ ਵਿੱਚ ਨਾ ਸਿੱਟਣ ਤਾਂ ਕਿ ਡਸਟਬੀਨ ਵਿੱਚ ਉਹਨਾਂ ਨੂੰ ਸਿੱਟਿਆ ਜਾਵੇ ਇੱਕ ਸੁੱਕਾ ਡਸਟਬੀਨ ਅਤੇ ਗਿਲਾ ਡਸਟਬਿਨ ਦੋ ਤਰ੍ਹਾਂ ਦੇ ਡਸਟਬਿਨ ਰੱਖਣੇ ਚਾਹੀਦੀ ਹਨ ਤਾਂ ਕਿ ਆਸੇ ਪਾਸੇ ਇਹ ਖਿਲਾਰਾ ਨਾ ਪਾਇਆ ਜਾਵੇ ਅਤੇ ਜੋ ਪਾਣੀ ਦਾ ਸਿਸਟਮ ਹੈ ਜੋ ਟੂਟੀ ਦਾ ਪਾਣੀ ਹੈ ਜਾਂ ਪੀਣ ਵਾਲਾ ਪਾਣੀ ਹੈ ਉਹ ਸਾਫ਼ ਸੁਥਰਾ ਹੋਣਾ ਚਾਹੀਦਾ ਹੈ ਉਸ ਲਈ ਸਾਡੇ ਪਿੰਡ ਵਿੱਚ ਆਰ ਓ ਦਾ ਪ੍ਰਬੰਧ ਕੀਤਾ ਹੋਇਆ ਹੈ ਜੋ ਕਿ ਉਸ ਵਿੱਚੋਂ ਜੋ ਗੰਦਾ ਪਾਣੀ ਨਿਕਲਦਾ ਹੈ ਉਹ ਛੱਪੜ ਵੱਲ ਨੂੰ ਕਰ ਦਿੱਤਾ ਜਾਂਦਾ ਹੈ ਅਤੇ ਛੱਪੜ ਉਸ ਤੋਂ ਬਾਅਦ ਉਸ ਜੋ ਪਾਣੀ ਛੱਪੜ ਵਿੱਚ ਜਾਂਦਾ ਹੈ ਉਸ ਦੇ ਵੀ ਮਹੀਨੇ ਤੋਂ ਸਫਾਈ ਕੀਤੀ ਜਾਂਦੀ ਹੈ ਅਤੇ ਉਹ ਸਫਾਈ ਕਰਨ ਤੋਂ ਬਾਅਦ ਕਈ ਵਾਰ ਉਸ ਵਿੱਚ ਜੋ ਮੱਛਲੀਆਂ ਹੁੰਦੀਆਂ ਹਨ ਜੇਕਰ ਉਣ ਉਸ ਪਾਣੀ ਦੀ ਸਫਾਈ ਨਾ ਕੀਤੀ ਜਾਵੇ ਤਾਂ ਉਹ ਮੱਛਲੀਆਂ ਮਰ ਜਾਂਦੀਆਂ ਹਨ ਇਸ ਲਈ ਉਸ ਛੱਪੜ ਦੀ ਸਫਾਈ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੈ ਸਫਾਈ ਦੇ ਟੋਪਿਕ ਨੂੰ ਲੈ ਕੇ ਸਿਰਫ ਆਪਣੇ ਆਲੇ ਦੁਆਲੇ ਦੀ ਨਹੀਂ ਬਲਕਿ ਸਾਰੇ ਪਿੰਡ ਦੀ ਸਫਾਈ ਜ਼ਰੂਰੀ ਹੈ ਜੇਕਰ ਅਸੀਂ ਸਾਰੀ ਸਫਾਈ ਰਲਕੇ ਕਰਦੇ ਹਾਂ ਅਤੇ ਪਾਣੀ ਦੇ ਰਿਲੇਟਡ ਕੁਝ ਜਿਵੇਂ ਕਿ ਟੂਟੀ ਦਾ ਪਾਣੀ ਆਉਂਦਾ ਹੈ ਉਸ ਲਈ ਪਿੰਡ ਸਾਰੇ ਪਿੰਡ ਵਿੱਚ ਪਾਈਪਾਂ ਲਗਾਈਆਂ ਗਈਆਂ ਹਨ ਤਾਂ ਕਿ ਹਰ ਘਰ ਵਿੱਚ ਪਾਣੀ ਟਾਈਮ ਸਿਰ ਜਾ ਸਕੇ ਘਰ ਵਿੱਚ ਆਰ ਓ ਵੀ ਲਗਾਏ ਗਏ ਹਨ ਜੇਕਰ ਅਸੀਂ ਘਰ ਬੈਠੇ ਹੀ ਪਾਣੀ ਸਾਫ਼ ਸੁਥਰਾ ਪੀਣਾ ਚਾਹੁੰਦੇ ਹਾਂ ਅਤੇ ਨਹਾਉਣ ਲਈ ਕੱਪੜੇ ਧੋਣ ਲਈ ਪਾਣੀ ਚਾਹੀਦਾ ਹੈ ਤਾਂ ਉਸ ਲਈ ਵੀ ਸਾਡੇ ਉਹ ਸਿਸਟਮ ਟੂਟੀਆਂ ਲਗਾਈਆਂ ਗਈਆਂ ਹਨ